ਪਟਿਆਲਾ ਦੇ ਵਿੱਚ ਜਿਹੜੀਆਂ ਮੁੱਖ ਫਸਲਾਂ ਉਗਾਈਆਂ ਜਾਂਦੀਆਂ ਉਹਨਾਂ ਦੇ ਵਿੱਚ ਚਾਵਲ ਕਣਕ ਦਾਲਾਂ ਅਤੇ ਸਬਜ਼ੀਆਂ ਨੇ ਸਬਜ਼ੀਆਂ ਜਿਹੜੀਆਂ ਮਲੇਰਕੋਟਲਾ ਦੇ ਵਿੱਚ ਬਹੁਤ ਜ਼ਿਆਦਾ ਉਗਾਈਆਂ ਜਾਂਦੀਆਂ ਨੇ ਜਿਹਨਾਂ ਦੀ ਬਹੁਤ ਜ਼ਿਆਦਾ ਮੰਗ ਹੈਗੀ ਅਤੇ ਜਿਹੜੀ ਕਣਕ ਦੀ ਫਸਲ ਆ ਉਹਦੇ ਲਈ ਨਵੰਬਰ ਦੇ ਵਿੱਚ ਬਾਹਣ ਤਿਆਰ ਕੀਤਾ ਜਾਂਦਾ ਸਭ ਤੋਂ ਪਹਿਲਾਂ ਬਾਹਣ ਨੂੰ ਵਾਹਿਆ ਜਾਂਦਾ ਅਤੇ ਫਿਰ ਕਣਕ ਦੀ ਬਜਾਈ ਕੀਤੀ ਜਾਂਦੀ ਆ ਅਤੇ ਜਿਹੜੀ ਕਣਕ ਦੀ ਵਾਢੀ ਆ ਉਹ ਅਪ੍ਰੈਲ ਦੇ ਵਿੱਚ ਕੀਤੀ ਜਾਂਦੀ ਆ ਵਾਢੀ ਕਰਨ ਤੋਂ ਬਾਅਦ ਉਸ ਨੂੰ ਮੰਡੀ ਦੇ ਵਿੱਚ ਲਿਜਾ ਕੇ ਵੇਚ ਦਿੱਤਾ ਜਾਂਦਾ ਗਾ ਅਤੇ ਝੋਨੇ ਦੀ ਫਸਲ ਦੇ ਲਈ ਮਈ ਦੇ ਵਿੱਚ ਆ ਜਿਹੜੀ ਪੌਧ ਬੀਜ ਦਿੱਤੀ ਜਾਂਦੀ ਹੈ ਅਤੇ ਜੂਨ ਦੇ ਵਿੱਚ ਤਿਆਰ ਹੋ ਕੇ ਉਸਨੂੰ ਲਗਾ ਦਿੱਤਾ ਜਾਂਦਾ ਪੰਦਰਾਂ ਜੂਨ ਤੋਂ ਬਾਅਦ ਆ ਜਿਹੜੀ ਸਰਕਾਰ ਦੇ ਦੁਆਰਾ ਪਰਮਿਸ਼ਨ ਹੁੰਦੀ ਹੈਗੀ ਕਿ ਅਸੀਂ ਉਸ ਨੂੰ ਬੀਜ ਸਕਦੇ ਹੈਗੇ ਪੰਦਰਾਂ ਜੂਨ ਤੋਂ ਬਾਅਦ ਆ ਜਿਹੜਾ ਝੋਨਾ ਲਗਾ ਦਿੱਤਾ ਜਾਂਦਾ ਗਾ ਅਤੇ ਨਵੰਬਰ ਦੇ ਵਿੱਚ ਆ ਕੇ ਝੋਨੇ ਦੀ ਵਾਢੀ ਕਰਕੇ ਉਸਨੂੰ ਮੰਡੀ ਦੇ ਵਿੱਚ ਲਿਜਾ ਕੇ ਵੇਚ ਦਿੱਤਾ ਜਾਂਦਾ